ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਰ ਸਾਲ ਹੀ ਯੂਥ ਫੈਸਟੀਵਲ ਕਰਵਾਉਂਦੇ ਹਨ ਉਸ ਵਿੱਚ ਲੋਕ ਨਾਚ ਹੁੰਦੇ ਹਨ ਉਨ੍ਹਾਂ ਦੀ ਵੀਡੀਓ ਕਲਿੱਪਾਂ ਬਣਦੀਆਂ ਨੇ ਅਤੇ ਉਹ ਯੂਟਿਊਬ 'ਤੇ ਅਵੇਲੇਬਲ ਹੁੰਦੀਆਂ ਨੇ ਉਸਨੂੰ ਆਪਾਂ ਦੇਖ ਸਕਦੇ ਹਾਂ ਹਰ ਤਰ੍ਹਾਂ ਦਾ ਲੋਕ ਨਾਚ ਹੰਦਾ ਗਿੱਧਾ ਵੀ ਕਰਵਾਉਂਦੇ ਹਨ ਭੰਗੜਾ ਵੀ ਹੁੰਦਾ ਸੰਮੀ ਝੂੰਮਰ ਅਲੱਗ ਅਲੱਗ ਤਰ੍ਹਾਂ ਦਾ ਲੋਕ ਨਾਚ ਕਰਵਾਇਆ ਜਾਂਦਾ ਉਸ ਤੋਂ ਦੇਖਿਆ ਦੇਖਦੇ ਹਾਂ ਬਹੁਤ ਕੁਛ ਸਿੱਖਦੇ ਹਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਸਾਨੂੰ ਉਸ ਤੋਂ